ਵੈਸੇ ਤਾਂ ਜੋ ਮੋਡਰਨ ਪੀੜ੍ਹੀ ਹੈ ਉਹ ਇੰਟਰਨੈੱਟ ਰਾਹੀਂ ਬੈਕਿੰਗ ਕਰ ਰਹੀ ਹੈ ਔਰ ਬਹੁਤ ਅੱਛੀ ਗੱਲ ਹੈ ਇਸ 'ਚ ਕੋਈ ਅਤਿ ਸ਼ੁਕਤੀ ਨਹੀਂ ਕਿ ਇਹ ਸਭ ਤੋਂ ਵੱਧ ਕਾਰਗਰ ਤਰੀਕਾ ਹੈ ਪੇਮੈਂਟ ਦਾ ਲੇਕਿਨ ਅਸੀਂ ਪੁਰਾਣੇ ਬੰਦੇ ਅਜੇ ਵੀ ਬੈਂਕ ਤੋਂ ਹੀ ਪੈਸੇ ਕੈਸ਼ ਕਢਾਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਆ ਸਾਨੂੰ ਮਜ਼ਾ ਵੀ ਆਉਂਦਾ ਕਿਉਂਕਿ ਘਰ ਬੈਠੇ ਫ਼ੋਨ ਕਰ ਦਈਦਾ ਵੀ ਇੰਨੇ ਪੈਸੇ ਕਢਾ ਕੇ ਰੱਖੀ ਉਹ ਬੈਂਕ ਵਾਲੀ ਜਾਕੇ ਸਾਡਾ ਵਿਚਾਰੀ ਲੜਕੀਆਂ ਲੜਕੇ ਸਾਈਨ ਕਰਾਂ ਲੈਂਦੇ ਆ ਸਾਨੂੰ ਤਾਂ ਏ ਟੀ ਐੱਮ ਜਿੰਨੀ ਸਹੂਲਤ ਆਮ ਬੈਂਕਾਂ 'ਚ ਵੀ ਹੈ ਇਸ ਕਰਕੇ ਕੋਈ ਪ੍ਰੋਬਲਮ ਨਹੀਂ